ਰਾਜ ਸਰਕਾਰ ਪੰਜਾਬ ਵਿੱਚ ਵੱਖ ਵੱਖ ਨੀਤੀਵਾਨ ਮੁੱਦਿਆਂ ਉੱਤੇ ਸਿੱਖਿਆ ਸਿਹਤ ਅਤੇ ਆਰਥਿਕਤਾ ਦੀ ਵੱਖ ਵੱਖ ਸੰਭਾਲ ਕਰ ਰਹੀ ਹੈ ਅੱਗੇ ਨਾਲੋਂ ਪੰਜਾਬ ਸਰਕਾਰ ਨੇ ਬੜੀ ਜ਼ਿਆਦਾ ਤਰੱਕੀ ਕਰ ਲਈ ਹੈ ਵੱਖ ਵੱਖ ਸਕੂਲ ਖੋਲ੍ਹੇ ਨੇ ਨਵੇਂ ਨਵੇਂ ਸਕੂਲ ਬਣਦੇ ਪਏ ਨੇ ਜਿਹੜੇ ਬੱਚਿਆਂ ਨੂੰ ਵਧੀਆ ਵਧੀਆ ਸ਼ਿਕਸ਼ਾ ਪ੍ਰਦਾਨ ਕੀਤੀ ਜਾਂਦੀ ਹੈ ਅੱਜ ਕੱਲ੍ਹ ਤਾਂ ਸਰਕਾਰੀ ਸਕੂਲਾਂ ਵਿੱਚ ਵੀ ਇੰਗਲਿਸ਼ ਮੀਡੀਅਮ ਦੀ ਪੜ੍ਹਾਈ ਕੀਤੀ ਜਾ ਰਹੀ ਹੈ ਅਤੇ ਵਧੀਆ ਵਧੀਆ ਹੌਸਪੀਟਲ ਵੀ ਖੋਲ੍ਹੇ ਜਾ ਰਹੇ ਨੇ ਪੀ ਜਿਹਦੇ ਵਿੱਚ ਦੁਨੀਆਂ ਦਾ ਇਲਾਜ ਵਧੀਆ ਤੋਂ ਵਧੀਆ ਹੋ ਸਕੇ ਅਤੇ ਅੱਜ ਕੱਲ੍ਹ ਪੰਜਾਬ ਸਰਕਾਰ ਨੇ ਵੱਖਰੀਆਂ ਵੱਖਰੀਆਂ ਨੌਕਰੀਆਂ ਵੀ ਲੋਕਾਂ ਵਾਸਤੇ ਪੜ੍ਹਾਈ ਲਿਖਾਈ ਕਰਕੇ ਜਿੱਦਾਂ ਅੱਗੇ ਨੌਕਰੀਆਂ 'ਤੇ ਵਿਚਾਰੇ ਬਾਹਰ ਜਾਂਦੇ ਸੀ ਹੁਣ ਪੰਜਾਬ ਸਰਕਾਰ ਨੌਕਰੀਆਂ ਵੀ ਬੜੀਆਂ ਬੜੀਆਂ ਸਰਕਾਰੀ ਲੋਕਾਂ ਵਾਸਤੇ ਦਿੰਦਾ ਪਿਆ ਲੋਕਾਂ ਨੂੰ ਤਾਂ ਕਿ ਉਹ ਆਪਣਾ ਇੱਥੇ ਪੰਜਾਬ 'ਚ ਰਹਿ ਕੇ ਹੀ ਆਪਣਾ ਘਰਬਾਰ ਆਪਣੇ ਮਾਂ ਪਿਓ ਦਾ ਪਾਲਣ ਪੋਸ਼ਣ ਕਰ ਸਕਣ ਅੱਗੇ ਵਿਚਾਰੇ ਬਾਹਰ ਚੱਲ ਜਾਂਦੇ ਸੀ ਅਤੇ ਮਾਂ ਪਿਓ ਪਿੱਛੋਂ ਵਿਚਾਰੇ ਤੱਕਦੇ ਰਹਿੰਦੇ ਸੀ ਇਕੱਲੇ ਬੈਠੇ ਰਹਿੰਦੇ ਸੀ ਹੁਣ ਬਹੁਤ ਵਧੀਆ ਹੋ ਗਿਆ ਇੱਥੇ ਸਰਕਾਰੀ ਨੌਕਰੀਆਂ ਸਰਕਾਰੀ ਸਕੂਲ ਅਤੇ ਸਰਕਾਰੀ ਹਸਪਤਾਲ ਬਹੁਤ ਵਧੀਆ ਹੋ ਗਿਆ ਇੰਡੀਆ ਦਾ ਧੰਨਵਾਦ ਜੀ